ਸਤਿ ਸ਼੍ਰੀ ਅਕਾਲ ਸਰ ਮੈਂ ਮਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਖੁਰਾਕ ਦੇਣ ਦੇਣ ਵਾਲਾ ਅਤੇ ਪਿੰਡ ਦੀ ਪੂਜਾ ਵਿੱਚ ਵਰਤੀਆਂ ਜਾਣ ਵਾਲੀਆਂ ਰੀਤੀ ਰਿਵਾਜ ਹੁੰਦਾ ਹੈ ਇਹ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰੰਪਰਾਵਾਂ ਦਾ ਅਹਿਮ ਹਿੱਸਾ ਹੈ ਅਤੇ ਵਿਸ਼ੇਸ਼ ਧਾਰਮਿਕ ਸ਼੍ਰੀ ਮਾਨ ਹੁੰਦੇ ਹਨ ਜੋ ਪਿੰਡ ਦੀ ਪੂਜਾ ਵਿੱਚ ਵਰਤੇ ਹਨ ਹਰ ਪਿੰਡ ਵਿੱਚ ਆਪਣੇ ਆਪਣੇ ਧਾਰਮਿਕ ਗੁਰਦੁਆਰੇ ਮੰਦਰ ਗੁਰਦੁਆਰੇ ਵਗੈਰਾ ਹੁੰਦੇ ਹਨ ਜਿਹਨਾਂ ਵਿੱਚ ਸੰਗਤ ਨਾਲ ਅਤੇ ਖੁਰਾਕ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਪਿੰਡ ਦੀ ਪੂਜਾ ਵਿੱਚ ਵਰਤਣ ਵਾਲੇ ਰੀਤੀ ਰਿਵਾਜ ਉਹਨਾਂ ਧਾਰਮਿਕ ਧਾਰਮਿਕ ਉਹਨਾਂ ਧਾਰਮਿਕ ਅਤੇ ਸਮਾਜਿਕ ਅਨੁਸਾਰ ਮਨਾਏ ਜਾਂਦੇ ਹਨ ਅਤੇ ਪਿੰਡ ਦੀ ਹਰ ਇੱਕ ਪਿੰਡ ਵਿੱਚ ਹੋਰ ਵੀ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ ਜੋ ਕਿ ਸੰਗਤ ਵੀ ਇਸ ਵਿੱਚ ਵਧ ਚੜ੍ਹ ਕੇ ਹਿੱਸਾ ਅਤੇ ਆਪਣਾ ਯੋਗਦਾਨ ਪਾਉਂਦੀ ਹੈ ਅਤੇ ਇਹਨਾਂ